ਹਾਂ ਮੈਨੂੰ ਲੱਗਦਾ ਹੈ ਕਿ ਮੀਡੀਆ ਅਤੇ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਨੂੰ ਉਚਿਤ ਰੂਪ ਵਿਚ ਦਰਸਾਇਆ ਜਾਂਦਾ ਹੈ ਪਰ ਇਸ ਬਾਰੇ ਸਭ ਕੁਝ ਹੋਰ ਬਰਾਬਰੀ ਨਾਲ ਹੋਣੀ ਨਹੀਂ ਚਾਹੀਦੀ ਹੈ ਜਿਵੇਂ ਕਿ ਅਸੀਂ ਇਸ ਵਿੱਚ ਸਾਹਿਤ ਸਿੱਖਿਆ ਅਤੇ ਸਮਾਚਾਰ ਵਿੱਚ ਪੰਜਾਬੀ ਦੀ ਵਰਤੋਂ ਵੱਧਦੀ ਜਾ ਰਹੀ ਹੈ ਪਰ ਹਮੇਸ਼ਾ ਵੱਧ ਦਾ ਵੱਧ ਇਹ ਹੋਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਕਈ ਗੱਲਾਂ ਜਿੱਦਾਂ ਕੀ ਮੀਡੀਆ ਦੀ ਭਾਸ਼ਾ ਵਿੱਚ ਉਚਿਤ ਰੂਪ ਨੂੰ ਪੰਜਾਬੀ ਦਰਸਾਉਣ ਨੂੰ ਲੈ ਕੇ ਇੱਕ ਹੈ ਕਿ ਜੇ ਲੋਕਾਂ ਨੂੰ ਆਪਣੀ ਭਾਸ਼ਾ ਦੀ ਗਹਿਰਾਈਆਂ ਨੂੰ ਸਮਝਣ ਮਤਲਬ ਕਿ ਉਹਦੇ ਵਿੱਚ ਜਾਣ ਦੀ ਗੱਲ ਕੀਤੀ ਜਾਵੇ ਅਤੇ ਮੀਡੀਆ ਦੀ ਭਾਸ਼ਾ ਵਿੱਚ ਖ਼ਬਰਾਂ ਨੂੰ ਸੰਬੋਧਿਤ ਉਹਨਾਂ ਦੇ ਤਰੀਕੇ ਨਾਲ ਅਨੁਵਾਦ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਦੇ ਉਚਿਤ ਸ੍ਰੋਤਾਂ ਦੇ ਰੂਪ ਵਿੱਚ ਪ੍ਰਦਾਨ ਕਰਨਾ ਬਹੁਤ ਹੈ ਤਾਂ ਕਿ ਇਹ ਸਾਡੇ ਸਟੂਡੈਂਟਸ ਨੂੰ ਆਪਣੀ ਭਾਸ਼ਾ ਵਿੱਚ ਸਿੱਖਿਆ ਮਿਲੇ ਅਤੇ ਉਹ ਅਚਾਨਕ ਬੋਲ ਸਕਦ ਭਾਸ਼ਾ ਦੇ ਸਮੂਹਾਂ ਵਿੱਚ ਸ਼ਾਮਿਲ ਹੋ ਸਕਣ ਇਹਨਾਂ ਨੂੰ ਹੋਰ ਲੰਬੇ ਪ੍ਰਸਤਾਵ ਕਰਨੇ ਚਾਹੀਦੇ ਹਨ ਜਿਵੇਂ ਕਿ ਇਸ ਪ੍ਰਸਤਾਵ ਨੂੰ ਅਮਲ ਵਿੱਚ ਲਿਆਉਣ ਲਈ ਸਰਕਾਰੀ ਸਹਿਯੋਗ ਸਿੱਖਿਆਂ ਸੰਸਥਾਵਾਂ ਅਤੇ ਮੀਡੀਆ ਤੰਤਸ਼ੀਲਾਂ ਦੀ ਉਦਹਾਰਨ ਨੂੰ ਵੀ ਜ਼ਰੂਰਤ ਹੈ ਇਸ ਨਾਲ ਸੁਰੱਖਿਆ ਤੋਂ ਲੈ ਕੇ ਸੋਸ਼ਲ ਐਜੂ ਇੰਗਲਿਸ਼ ਨੇ ਤੌਰ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਰੀ ਸਮੁੱਚੀ ਜਨਤਾ ਨੂੰ ਫਲ ਤੌਰ 'ਤੇ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਕਈ ਸਕੂਲਾਂ ਨੂੰ ਵੀ ਇਸਤੇ ਜਾ ਉਪਰੰਤ ਤਬਦੀਲ ਕਰਨੀ ਚਾਹੀਦੀ ਹੈ ਕਿ ਜਿਵੇਂ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਬਾਰਵੀਂ ਤੱਕ ਪੰਜਾਬੀ ਕਰਾਉਣੀ ਚਾਹੀਦੀ ਹੈ ਪਰ ਅੱਜ ਕੱਲ੍ਹ ਦੇ ਸਕੂਲਾਂ ਵਿੱਚ ਅੱਠਵੀਂ ਤੱਕ ਪੰਜਾਬੀ ਕਰਾਉਂਦੇ ਹਨ ਉਸ ਤੋਂ ਬਾਅਦ ਇੰਗਲਿਸ਼ ਦੇ ਵੱਲ ਹੀ ਜ਼ੋਰ ਦੇਈ ਜਾਂਦੇ ਹਨ ਇਹ ਗੱਲਾਂ ਪੰਜਾਬੀ ਨੂੰ ਥੋੜ੍ਹਾ ਦੂਰ ਲੈ ਕੇ ਜਾਈ ਜਾ ਰਹੀਆਂ ਹਨ ਸਾਨੂੰ ਇਹ ਹੀ ਤਰੀਕਾ ਨੂੰ ਅਪ ਅਪਣਾਉਣ ਦੀ ਜ਼ਿਆਦਾ ਸਾਨੂੰ ਪੂਰੇ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਨੂੰ ਵੱਡੇ ਸਤਰ ਤੱਕ ਖੜਨਾ ਚਾਹੀਦਾ ਹੈ ਇੰਟਰ ਇੰਟਰਨੈਟ ਅਤੇ ਗੂਗਲ 'ਤੇ ਵੀ ਪੰਜਾਬੀ ਨੂੰ ਬੜੇ ਵਧੀਆ ਤਰੀਕੇ ਨਾਲ ਦਰਸਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਪੰਜਾਬੀ ਭਾਸ਼ਾ ਨੂੰ ਸਿੱਖੇ ਅਤੇ ਸਮਝਣ ਦੀ ਕੋਸ਼ਿਸ਼ ਕਰ ਸਕੇ ਧੰਨਵਾਦ